ਪੰਜਾਬ ਵਿੱਚ ਬਹੁਤ ਸਾਰੀਆਂ ਸਪੋਰਟਸ ਟੀਮਾਂ ਇਵੈਂਟਸ ਖੇਡਾਂ ਹਨ ਜੋ ਹਰ ਇੱਕ ਪ੍ਰਸ਼ੰਸਕ ਨੂੰ ਆਕਰਸ਼ਿਤ ਕਰਦੀਆਂ ਹਨ ਇਹਨਾਂ ਵਿੱਚ ਸਭ ਤੋਂ ਮੇਨ ਖੇਡ ਕਬੱਡੀ ਹੈ ਪੰਜਾਬ ਵਿੱਚ ਜਿੰਨਾ ਕਬੱਡੀ ਦਾ ਕਰੇਜ ਹੈ ਕਿਸੇ ਹੋਰ ਖੇਡ ਦਾ ਇੰਨਾ ਨਹੀਂ ਕਬੱਡੀ ਖੇਡ ਵੀ ਪੰਜਾਬ ਦੀ ਹੈ ਅਤੇ ਪੰਜਾਬ ਵਿੱਚ ਹੀ ਜ਼ਿਆਦਾ ਖੇਡੀ ਜਾਂਦੀ ਹੈ ਪੰਜਾਬ ਵਿੱਚ ਕਬੱਡੀ ਟੂਰਨਾਮੈਂਟ ਵੀ ਕਰਾਏ ਜਾਂਦੇ ਹਨ ਜਿਨਾਂ ਵਿੱਚੋਂ ਖਿਡਾਰੀ ਖਿਡਾਰੀਆਂ ਨੂੰ ਬਹੁਤ ਵਧੀਆ ਇਨਾਮ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੀ ਬੁਰੀ ਸਿਹਤ ਦਾ ਧਿਆਨ ਵੀ ਰੱਖਿਆ ਜਾਂਦਾ ਹੈ ਅਤੇ ਕਬੱਡੀ ਟੂਰਨਾਮੈਂਟ ਦੇਖਣ ਸਾਰੇ ਪ੍ਰਸ਼ੰਸਕ ਬਹੁਤ ਹੁੰਮ ਹੁੰਮਾ ਕੇ ਜਾਂਦੇ ਹਨ ਅਤੇ ਹਰ ਇੱਕ ਟੀਮ ਨੂੰ ਬਹੁਤ ਵਧੀਆ ਮਾਣ ਅਤੇ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਕਬੱਡੀ ਤੋਂ ਇਲਾਵਾ ਪੰਜਾਬ ਵਿੱਚ ਕ੍ਰਿਕਟ ਨੂੰ ਵੀ ਬਹੁਤ ਵਧੀਆ ਪਸੰਦ ਕੀਤਾ ਜਾਂਦਾ ਹੈ ਪਿੰਡਾਂ ਵਿੱਚ ਵੀ ਜਵਾਕ ਜਾਂ ਹੋਰ ਵੱਡੇ ਵੀ ਨੌਜਵਾਨ ਕ੍ਰਿਕਟ ਨੂੰ ਸ਼ਾਮ ਸਵੇਰੇ ਖੇਡਦੇ ਹਨ ਅਤੇ ਕ੍ਰਿਕਟ ਦੇ ਵੀ ਟੂਰਨਾਮੈਂਟ ਕਰਵਾਏ ਜਾਂਦੇ ਹਨ ਛੋਟੇ ਪੱਧਰ 'ਤੇ ਅਤੇ ਉਹਤੋਂ ਬਾਅਦ ਜੇ ਕ੍ਰਿਕਟ ਨੂੰ ਘਰ ਬਹਿ ਕੇ ਅਤੇ ਟੀ ਵੀ 'ਤੇ ਵੀ ਬਹੁਤ ਸਾਰਾ ਪਰਿਵਾਰ ਇਕੱਠਾ ਹੋ ਕੇ ਦੇਖਦਾ ਯਾਨੀ ਕ੍ਰਿਕਟ ਦਾ ਵੀ ਹੈਗਾ ਹੈ ਥੋੜ੍ਹਾ ਜਿਹਾ ਕਰੇਜ਼ ਪੰਜਾਬ ਵਿੱਚ